ਸਾਡੇ ਰਾਜ ਦੇ ਪੰਜਾਬ ਰਾਜ ਦੇ ਬਹੁਤ ਸਾਰੇ ਕਬੀਲੇ ਹਨ ਕਬੀਲਿਆਂ ਨੂੰ ਵੀ ਮੁੱਖ ਤੌਰ 'ਤੇ ਜਿਵੇਂ ਪਿੰਡਾਂ ਨੂੰ ਹੀ ਕਬੀਲੇ ਹੀ ਕਿਹਾ ਜਾਂਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਪਰ ਕਈ ਜਿਵੇਂ ਗੱਡੀਆਂ ਵਾਲੇ ਹੋ ਗਏ ਗੱਡੀਆਂ ਵਾਲੇ ਸਾਤੋਂ ਲੋਹੇ ਦਾ ਸਾਡੇ ਜਿਵੇਂ ਕਿ ਸਮਾਨ ਘਰ ਦੇ ਵਿੱਚ ਟੁੱਟ ਭੱਜ ਜਾਂਦਾ ਹੁੰਦਾ ਸੀ ਤਾਂ ਉਹ ਵਿਚਾਰੇ ਆਉਂਦੇ ਸੀਗੇ ਔਰ ਸਾਤੋਂ ਉਹਨਾਂ ਨੇ ਬਰਤਨ ਸਾਡੇ ਜੋ ਲੋਹੇ ਦੇ ਸਾਡੇ ਖਰਾਬ ਹੋ ਜਾਂਦੇ ਪਿੱਤਲ ਦੇ ਸਾਡੇ ਖਰਾਬ ਹੋ ਜਾਂਦੇ ਸੀ ਚਿਮਟੇ ਸਾਡੇ ਖਰਾਬ ਹੋ ਜਾਂਦੇ ਸੀਗੇ ਉਹਨਾਂ ਨੂੰ ਠੀਕ ਕਰ ਦਿੰਦੇ ਸੀ ਔਰ ਉਸਦੇ ਬਦਲੇ ਉਹ ਅਨਾਜ ਲੈ ਜਾਂਦੇ ਸੀਗੇ ਖਾਣ ਲਈ ਇਹ ਸਾ ਉਹਨਾਂ ਦਾ ਇਹ ਮੁੱਖ ਕਿੱਤਾ ਸੀ ਜਿਵੇਂ ਕਿ ਹੁਣ ਇੱਕ ਗੱਡੀਆਂ ਵਾਲੇ ਹੋ ਗਏ ਗੱਡੀਆਂ ਵਾਲਿਆਂ ਦਾ ਮੈਂ ਦੱਸ ਚੁੱਕਿਆ ਹਾਂ ਜਿਵੇਂ ਗੁੱਜਰ ਹੋ ਗਏ ਗੁੱਜਰਾਂ ਦਾ ਕੰਮ ਕੀ ਹੁੰਦਾ ਮੈਂਸਾਂ ਚਾਰਦੇ ਫਿਰਦੇ ਰਹਿੰਦੇ ਹਨ ਉਹ ਪਰ ਉਹਨਾਂ ਤੋਂ ਉਹ ਦੁੱਧ ਬ ਬੱਚਿਆਂ ਮ ਆਪਣੇ ਪਿੰਡਾਂ ਲਈ ਦੁੱਧ ਵੇਚਦੇ ਹਨ ਅਤੇ ਸ਼ਹਿਰਾਂ ਦੇ ਵਿੱਚ ਵੀ ਕਈ ਵਾਰ ਸਪਲਾਈ ਕਰਦੇ ਹਨ ਸਾਨੂੰ ਉਹਨਾਂ ਲਈ ਬਹੁਤ ਹੀ ਜ਼ਿਆਦਾ ਉਹਨਾਂ ਲਈ ਹਮਦਰਦੀ ਰੱਖਣੀ ਚਾਹੀਦੀ ਹੈ ਜਦੋਂ ਉਹ ਸਾਡੇ ਕੋਲ ਆਉਂਦੇ ਹਾਂ ਤਾਂ ਸਾਨੂੰ ਉਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਉਹਨਾਂ ਦਾ ਇੱਕ ਹੀ ਕਿੱਤਾ ਹੈ